ਭਾਅ ਜੀ ਸਾਡੀ ਗੱਲ ਵੰਸ਼ ਨਾਲ ਹੁੰਦੀ ਆ ਭਾਅ ਜੀ ਮੈਂ ਨਾ ਟ੍ਰੈਫਿਕ ਪੁਲਿਸ ਵਾ ਤੁਹਾਡੀ ਨਾ ਕੰਪਲੇਂਟ ਆਈ ਹੈ ਤੁਸੀਂ ਪਰਸੋਂ ਚੌਂਕ ਦੇ ਲਾਗੋਂ ਨਾ ਕਾਫ਼ੀ ਓਵਰ ਸਪੀਡਿੰਗ ਕਰਕੇ ਨਿਕਲੇ ਜੇ ਤੁਹਾਡੀ ਕਾਫ਼ੀ ਓਵਰ ਸਪੀਡਿੰਗ ਸੀ ਇਸ ਕਰਕੇ ਤੁਹਾਨੂੰ ਚਲਾਣ ਪੈਣਾ ਭਾਅ ਜੀ ਤੁਹਾਨੂੰ ਪਤਾ ਅੱਜ ਕੱਲ੍ਹ ਕਾਫ਼ੀ ਕੈਮਰੇ ਲੱਗੇ ਹੋਏ ਨੇ ਉਹਦੇ ਵਿੱਚ ਤੁਹਾਡੀ ਰਿਕਾਰਡਿੰਗ ਵੀ ਆਈ ਹੋਈ ਆ ਸਾਨੂੰ ਸਾਡੇ ਇੱਥੇ ਜਿਹੜੇ ਸਾਡਾ ਹੈਗਾ ਮੇਨ ਜਿਹੜਾ ਹੈਡ ਹੈਗੇ ਆ ਉਹਨਾਂ ਨਾਲ ਤੁਹਾਨੂੰ ਆ ਕੇ ਗੱਲ ਕਰਨੀ ਪੈਣੀ ਹੈ ਤੁਹਾਨੂੰ ਫਾਈਨ ਪੈਣਾ ਚਲੋ ਠੀਕ ਹੈ ਭਾਅ ਜੀ ਓਕੇ